ਭੋ ਭਾਸ਼ਾ ਭੋਜਨ ਕੱਪੜੇ ਮੌਸਮ ਰਾਜਨੀਤੀ ਭੰਗੋਲ ਇਹਨਾਂ ਦੇ ਅਧਾਰ 'ਤੇ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਇਹ ਦੋਨੋਂ ਹੀ ਬਹੁਤ ਹੀ ਅਲੱਗ ਹਨ ਇਹ ਉੱਤਰੀ ਭਾਰਤ ਵਿੱਚ ਜਿਵੇਂ ਕਿ ਪੰਜਾਬ ਅਤੇ ਹਿਮਾਲਿਆ ਇਹ ਆਦਿ ਆ ਜਾਂਦੇ ਹਨ ਇਹਨਾਂ ਦਾ ਪਹਿਰਾਵਾ ਜਿਵੇਂ ਕਿ ਕੁਰਤਾ ਪਜਾਮਾ ਸਲਵਾਰ ਕਮੀਜ ਚਾਦਰਾ ਆਦਿ ਹੈ ਅਤੇ ਜੇਕਰ ਗੱਲ ਕਰਾਂ ਮੈਂ ਦੱਖਣੀ ਭਾਰਤ ਦੀ ਇਸ ਵਿੱਚ ਵੈਸਟ ਬੰਗੋਲ ਝਾਰਖੰਡ ਬਿਹਾਰ ਇਹ ਆ ਜਾਂਦੇ ਹਨ ਇਹਨਾਂ ਦੇ ਇਹਨਾਂ ਦਾ ਪਹਿਰਾਵਾ ਅਤੇ ਰਹਿਣ ਸਾਨ ਖਾਣ ਪੀਣ ਬਹੁਤ ਹੀ ਅਲੱਗ ਹੈ ਇਹਨਾਂ ਵਿ ਇਹਨਾਂ ਉੱਤਰੀ ਭਾਰਤ ਦੱਖਣੀ ਭਾਰਤ ਇਹ ਆਪਸ ਵਿੱਚ ਦੋਨੋਂ ਹੀ ਬਹੁਤ ਹੀ ਅਲੱਗ ਅਲੱਗ ਹਨ